ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਤਾਂ ਜਿੰਨੀਆਂ ਵੀ ਮੇਰੀਆਂ ਕਿਤਾਬਾਂ ਕੋਲੋਂ ਮੈਨੂੰ ਵਾਰੀ ਵਾਰੀ ਮੈਂ ਪੜ੍ਹਨ ਪੜ੍ਹਨੇ ਸ਼ੁਰੂ ਕਰ ਦਿੰਦਾ ਹਾਂ ਜ਼ਿਆਦਾਤਰ ਤਾਂ ਮੈਂ ਕਿਸੇ ਵੀ ਕਿਤਾਬ ਨੂੰ ਪੜਣ ਲਈ ਇੱਕ ਜਾਂ ਅੱਧਾ ਦਿਨ ਇੱਦਾਂ ਦੇ ਹਿਸਾਬ ਨਾਲ ਚੱਲ ਕੇ ਮੰਨ ਕੇ ਚੱਲ ਲਉ ਤਾਂ ਲਾਹਾ ਲੈਂਦਾ ਹਾਂ ਜਦੋਂ ਕਿਸੇ ਕੋਈ ਵੀ ਕਿਤਾਬ ਜ਼ਿਆਦਾ ਵਧੀਆ ਲੱਗਦੀ ਹੈ ਡੁੰਘਾਈ ਦੀ ਗੱਲ ਹੁੰਦੀ ਹੈ ਤਾਂ ਉਸਨੂੰ ਮੈਂ ਲਗਾਤਾਰ ਪੜ੍ਹਦਾ ਹੀ ਰਹਿੰਦਾ ਹੈ ਅਤੇ ਘੰਟੇ ਕੁ ਵਿੱਚ ਪੜ੍ਹ ਕੇ ਉਸਦੇ ਸਮਝ ਕੇ ਤੇ ਉਸਨੂੰ ਅਤੇ ਅਗਲੀ ਕਿਤਾਬ ਸ਼ੁਰੂ ਕਰ ਲੈਂਦਾ ਹਾਂ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਜਿਵੇਂ ਕਿ ਰਾਣੀ ਤੱਤ ਮਹਾਨਕੋਸ਼ ਆਦਿ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਪਈਆਂ ਵੀ ਹਨ ਮੈਂ ਬਾ ਕਈ ਕੁਝ ਕਿਤਾਬਾਂ ਦੁਆਰਾ ਦੁਆਰਾ ਵੀ ਪੜ੍ਹੀਆਂ ਹਨ ਜੋ ਮੈਨੂੰ ਚੰਗੀਆਂ ਲੱਗੀਆਂ ਕਿਤਾਬਾਂ ਵਿੱਚ ਬਹੁਤ ਹੀ ਕੁਝ ਜ਼ਿਆਦਾ ਸਿੱਖਣ ਨੂੰ ਮਿਲਦਾ ਹੈ ਕਿਤਾਬਾਂ ਬੜੀਆਂ ਚੰਗੀਆਂ ਗੱਲਾਂ ਹੁੰਦੀਆਂ ਹਨ ਜਿਵੇਂ ਜੋ ਮੈਂ ਸਿੱਖਦਾ ਹਾਂ ਅਤੇ ਬਾਅਦ ਵਿੱਚ ਮੈਂ ਖੁਦ ਵੀ ਆਪਣੀ ਲਿਖ ਲਿਖਦਾਂ ਹਾਂ ਮੈਨੂੰ ਲਿਖਣਾ ਵੀ ਵਧੀਆ ਲੱਗਦਾ ਹੈ ਅਤੇ ਪੜ੍ਹਨਾ ਵੀ ਕਿਤਾਬਾਂ ਪੜ੍ਹਨ ਲਈ ਜ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਮੈਂ ਆਪਣਾ ਵਿਹਲਾ ਟੈਮ ਭਾਵੇਂ ਟੈਮ ਆਪਣੇ ਕੰਮ 'ਚੋਂ ਟੈਮ ਕੱਢ ਕੇ ਕਿਤਾਬ ਨੂੰ ਦਿੰਦਾ ਹਾਂ ਅਤੇ ਕਿਤਾਬ ਪੜ੍ਹਦਾ ਰਹਿੰਦਾ ਹਾਂ ਜਿਸ ਨਾਲ ਮੈਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ